ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਤੁਹਾਨੂੰ ਕਿੱਦਾਂ ਦਾ ਕਿਸ ਸਟਾਇਲ ਦਾ ਮਕਾਨ ਚਾਹੀਦਾ ਹਾਂ ਕਿੰਨੇ ਕਮਰੇ ਹੋਣ ਕੀ ਕੁਛ ਹੋਣਾ ਚਾਹੀਦਾ ਹਾਂਜੀ ਹਾਂਜੀ ਅਤੇ ਹਾਂਜੀ ਠੀਕ ਆ ਜੀ ਅਤੇ ਤੁਸੀਂ ਕਿੰਨੀ ਕੁ ਕੀਮਤ ਲਾ ਸਕਦੇ ਹੋ ਅੱਛਾ ਜੀ ਪੰਜ ਲੱਖ ਦੇ ਵਿੱਚ ਤਾਂ ਫਿਰ ਜਿੰਨਾ ਕੁਛ ਤੁਸੀਂ ਕਹਿ ਰਹੇ ਹੋ ਇਹ ਤਾਂ ਫਿਰ ਔਖਾ ਹੈ ਨਾ ਪੰਜ ਲੱਖ ਦੇ ਵਿੱਚ ਤਾਂ ਦੋ ਕਮਰੇ ਇੱਕ ਰਸੋਈ ਅਤੇ ਬਾਥਰੂਮ ਵਗੈਰਾ ਹੋ ਸਕਦਾ ਅਤੇ ਪਰ ਅ ਤੁਸੀਂ ਬਸ ਇਹ ਇਹ ਹੀ ਲੈਣਾ ਚਾਹੁੰਦੇ ਹੋ ਜਾਂ ਕਿਰਾਏ 'ਤੇ ਵੀ ਲੈ ਸਕਦੇ ਹੋ ਅੱਛਾ ਕਿਰਾਏ 'ਤੇ ਅਤੇ ਤੁਸੀਂ ਕਿਰਾਇਆ ਕਿੰਨਾ ਕੁ ਦੇ ਸਕਦੇ ਹੋ ਮੰਥ ਮਹੀਨੇ ਬਾਅਦ ਦੋ ਹਜ਼ਾਰ 'ਚ ਤਾਂ ਫਿਰ ਇੱਥੇ ਦੇਖਣਾ ਪਊਗਾ ਅ ਤੁਹਾਡੇ ਇੱਥੇ ਨੇੜ ਨੇੜੇ ਨਾ ਕਿਤੇ ਇਲਾਕੇ ਦੇ ਵਿੱਚ ਅ ਹੈਗੇ ਨੇ ਉੱਥੇ ਘਰ ਅ ਕਿਰਾਏ 'ਤੇ ਵੀ ਨੇ ਅਤੇ ਇਸ ਤਰ੍ਹਾਂ ਉਂਝ ਵੀ ਹੈਗੇ ਜੇ ਆਪਾਂ ਮੁਲ ਮੁੱਲ ਵੀ ਲੈਣੇ ਆ ਉਹ ਉਹੋ ਜਿਹਾ ਫਿਰ ਆਪਾਂ ਉਸ ਤਰੀਕੇ ਨਾਲ ਦੇਖ ਲਵਾਂਗੇ ਪਤਾ ਕਰ ਲਵਾਂਗੇ ਅਤੇ ਹਾਂਜੀ ਆਪਾਂ ਉਸ ਤਰ੍ਹਾਂ ਦਾ ਦੇਖ ਲਵਾਂਗੇ ਇੱਥੇ ਨੇੜੇ ਤੁਹਾਡੇ ਹਾਂ ਆਪਾਂ ਇਸ ਇਲਾਕੇ 'ਚ ਨਾ ਉਸ ਇਲਾਕੇ ਦੇ ਵਿੱਚ ਵੇਖ ਲਵਾਂਗੇ ਅਤੇ ਉਹ ਆਪਾਂ ਨੂੰ ਹਾਂ ਚਲੋ ਆਪਾਂ ਉਹ ਹੀ ਦੇਖ ਲਵਾਂਗੇ ਉਹ ਤਾਂ ਐਂ ਆ ਵੀ ਸਾਡੀ ਨਿਗ੍ਹਾ ਦੇ ਵਿੱਚ ਤਾਂ ਬਹੁਤ ਘਰ ਨੇ ਅਤੇ ਉਹ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਇਸ ਤਰ੍ਹਾਂ ਦੀ ਬਣੇ ਵੀ ਮਿਲ ਜਾਣਗੇ ਜੇ ਕਿਰਾਏ 'ਤੇ ਵੀ ਮਿਲ ਜਾਣਗੇ ਅਤੇ ਹਾਂ ਹੈਗੇ ਆ ਇਸ ਤਰ੍ਹਾਂ ਆਪਣਾ ਕੋਲ ਅਤੇ ਆਪਾਂ ਤੁਹਾਨੂੰ ਜਿਹੜਾ ਵੀ ਸੈਟ ਹਾਂ ਪਾਣੀ ਦਾ ਵੀ ਸਾਰਾ ਕੁਛ ਦੇਖਣਾ ਪੈਣਾ ਨਾ ਆਪਾਂ ਨੂੰ ਸਾਰਾ ਉਸ ਤਰੀਕੇ ਨਾਲ ਹਾਂ ਸੀ ਪਾਣੀ ਸੀਵਰੇਜ ਵਿੱਚ ਜਾਂਦਾ ਹੋਵੇ ਐਵੇਂ ਉੱਥੇ ਚਿੱਕੜ ਨਾ ਹੋਵੇ ਨਾ ਅਤੇ ਹਾਂ ਅ ਸੀਵਰੇਜ ਹੋਵੇ ਅਤੇ ਹੋਰ ਵੀ ਸੜਕ ਅਤੇ ਉਹਨੂੰ ਰਸਤਾ ਵੀ ਵਧੀਆ ਅੱਛਾ ਇਹ ਚਾਹੁੰਦੇ ਤੁਸੀਂ ਠੀਕ ਆ ਅਤੇ ਉਹ ਜ਼ਰੂਰ ਅਸੀਂ ਨਿਗ੍ਹਾ 'ਚ ਰੱਖਦੇ ਹਾਂ ਅਤੇ ਤੁਸੀਂ ਫਿਰ ਕਿਸੇ ਦਿਨ ਹਾਂ ਤੁਸੀਂ ਤੁਸੀਂ ਤੁਸੀਂ ਟਾਈਮ ਕੱਢਿਓ ਕਿਸੇ ਦਿਨ ਅਤੇ ਤੁਹਾਨੂੰ ਸਾਰੇ ਘਰ ਦਿਖਾ ਦਾਂਗੇ ਹਾਂਜੀ ਹਾਂਜੀ ਕਿਰਾਇਆਂ ਵਾਲੇ ਵੀ ਅਤੇ ਠੀਕ ਆ ਜੀ ਧੰਨਵਾਦ